ਇੱਕ ਇਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਸੱਭਿਆਚਾਰ ਕੀ ਹੈ ਹਿੰਦੂ ਮੁਸਲਿਮ ਸਿੱਖ ਈਸਾਈ ਇਹ ਸਾਰੇ ਆਪਣੇ ਆਪਣੇ ਬੇਸ਼ੱਕ ਇਨ੍ਹਾਂ ਦੇ ਧਰਮ ਹੈ ਲੇਕਿਨ ਸੱਭਿਆਚਾਰ ਕੀ ਹੈ ਆਪਣਾ ਪਿਆਰ ਮੁਹੱਬਤ ਅਗਰ ਅਸੀਂ ਪਿਆਰ ਨਾਲ ਰਹਿੰਦੇ ਹਾਂ ਮੁਹੱਬਤ ਨਾਲ ਰਹਿੰਦੇ ਹਾਂ ਇੱਕ ਦੂਜੇ ਨੂੰ ਮਿਲਦੇ ਜੁਲਦੇ ਹਾਂ ਦੂਜੇ ਦੇ ਤਿਉਹਾਰਾਂ ਦੇ ਨਾਲ ਅਸੀਂ ਇੱਕ ਦੂਜੇ ਨਾਲ ਮਿਲ ਵਰਤ ਕੇ ਇੱਕ ਦੂਜੇ ਦੇ ਤਿਉਹਾਰ ਜਿੱਦਾਂ ਦੀਵਾਲੀ ਆ ਗਿਆ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਮਿਲ ਕੇ ਅਸੀਂ ਦੀਵਾਲੀ ਮਨਾਉਂਦੇ ਹਾਂ ਈਦ ਆ ਗਿਆ ਉਹਦੇ ਵਿੱਚ ਵੀ ਅਸੀਂ ਸਾਰੇ ਮਿਲਕੇ ਕਰਦੇ ਹਾਂ ਈਸਾਈਆਂ ਦੇ ਵਿੱਚ ਕ੍ਰਿਸ਼ਮਿਸ ਹੈ ਉਹ ਵੀ ਮਿਲ ਜੁਲ ਕੇ ਕ ਅਸੀਂ ਮਨਾਉਂਦੇ ਹਾਂ ਉਹੀ ਸੱਭਿਆਚਾਰ ਹੈ ਉਹੀ ਸਾਡੇ ਤਿਉਹਾਰ ਹੈ ਉਹੀ ਸਾਡੇ ਸਮਾਜ ਹੈ